ਹਾਂਜੀ ਭਾਅ ਜੀ ਭਾਅ ਜੀ ਉਹ ਆਪਣਾ ਲੈਪਟੋਪ ਲੈ ਕੇ ਗਿਆ ਆਪਾਂ ਤੁਹਾਡੇ ਕੋਲੋਂ ਨਵਾਂ ਅਤੇ ਇਹ ਲੈਪਟੋਪ ਬਹੁਤ ਵਧੀਆ ਰਿਹਾ ਜੀ ਇਹ ਪਹਿਲੇ ਜਿਹੜਾ ਸਾਡਾ ਲੈਪਟੋਪ ਸੀ ਉਹਦੀ ਤਾਂ ਸਪੀਡ ਬੜੀ ਸਲੋਅ ਸੀ ਚਲਦਾ ਨਹੀਂ ਸਾਈਟਾਂ ਨਹੀਂ ਸੀ ਖੁੱਲ੍ਹਦੀਆਂ ਜੀ ਉਹਦੀਆਂ ਅਤੇ ਜੇ ਖੁੱਲ੍ਹਦੀਆਂ ਵੀ ਤਾਂ ਐਂ ਬਹੁਤ ਕਿੰਨਾ ਚਿਰ ਤਾਂ ਉਹਦਾ ਚੱਕਰ ਜਿਹਾ ਘੁੰਮਦਾ ਰਹਿੰਦਾ ਸੀ ਤਾਂ ਫੇਰ ਉਹਦੀ ਕਿਤੇ ਜਾ ਕੇ ਸਾਈਡ ਖੁੱਲ੍ਹਦੀ ਸੀ ਇਹ ਲੈਪਟੋਪ ਜੀ ਠੀਕ ਰਿਹਾ ਜੀ ਕਾਫੀ ਵਧੀਆ ਲੈਪਟੋਪ ਇਹ ਸਪੀਡ ਵੀ ਇਹਦੀ ਜ਼ਿਆਦਾ ਆ ਅਤੇ ਸਾਈਡ ਬਹੁਤ ਜਲਦੀ ਖੁੱਲ੍ਹਦੀ ਹੈਗੀ ਆ ਹਾਂਜੀ ਅਤੇ ਉੱਦਾਂ ਵੀ ਜਿਹੜੀ ਪਿਕਚਰ ਕੁਆਲਟੀ ਵੀ ਜਿਹੜੀ ਆ ਨਾ ਜਿਹੜੀ ਸਕਰੀਨ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਬੈਟਰੀ ਬੈਕਅੱਪ ਵੀ ਚੰਗਾ ਵਾ ਅਤੇ ਇਹ ਲੈਪਟੋਪ ਕਾਫੀ ਹੱਦ ਤੱਕ ਚੰਗਾ ਪਹਿਲੇ ਨਾਲੋਂ ਤਾਂ ਸੌਫਟਵੇਅਰ ਸਿਸਟਮ ਵੀ ਬੜਾ ਵਧੀਆ ਸੌਫਟਵੇਅਰ ਵੀ ਐਨ ਬਹੁਤ ਸੌਫਟ ਚਲਦਾ ਸਾਈਡਾਂ ਬਹੁਤ ਜਲਦੀ ਖੁੱਲ੍ਹਦੀਆਂ ਇਹਦੀਆਂ ਅਤੇ ਟੱਚ ਸਕਰੀਨ ਜਿਹੜਾ ਹੈਗਾ ਪਹਿਲਾਂ ਦੂਸਰਾ ਸੀ ਇਹ ਟੱਚ ਸਕਰੀਨ ਆ ਅਤੇ ਸਕਰੀਨ ਦੀ ਟੱਚ ਵੀ ਜਿਹੜੀ ਆ ਇਹਨਾਂ ਦੀ ਬਹੁਤ ਵਧੀਆ ਚਲਦੀ ਹੈ ਸੌਫਟ ਟੱਚ ਚਲਦੀ ਹੈ ਬ੍ਰਾਈਟਨੈੱਸ ਵੀ ਚੰਗੀ ਹੈ ਅਤੇ ਇਹਦੇ ਨਾਲ ਨਾ ਅੱਖ ਅੱਖਾਂ 'ਤੇ ਵੀ ਜਿਹੜਾ ਜਿਹੜਾ ਬਹੁਤ ਘੱਟ ਅਸਰ ਪੈਂਦਾ ਵਾ ਜਿਹੜੀ ਇਹਦੀ ਲਾਈਟ ਦਾ ਪਹਿਲੇ ਦੇ ਨਾਲ ਕੀ ਆ ਅੱਖਾਂ ਥੱਕ ਜਾਂਦੀਆਂ ਸੀ ਪਰ ਪਰ ਇਹ ਇਹਦੇ ਨਾਲ ਠੀਕ ਰਹਿੰਦੀਆਂ ਹਾਂਜੀ